ਮੈਂ ਸਵੇਰੇ ਸ਼ਾਮ ਪੰਜ ਤੋਂ ਛੇ ਕਿਲੋਮੀਟਰ ਦੌੜ ਲਗਾਉਂਦਾ ਹਾਂ ਜਿਸ ਨਾਲ ਮੇਰੀ ਸਿਹਤ ਵੀ ਸਹੀ ਰਹਿੰਦੀ ਹੈ ਜਿਸ ਦੇ ਨਾਲ ਮੈਨੂੰ ਕਿ ਕੋਈ ਵੀ ਬਿਮਾਰੀ ਜਲਦੀ ਨਹੀਂ ਲੱਗ ਸਕਦੀ ਕਿਉਂਕਿ ਪਸੀਨਾ ਜੋ ਮੇਰੇ ਦੋ ਟਾਈਮ ਨਿਕਲਣਾ ਪਸੀਨਾ ਹਰ ਇੱਕ ਨੂੰ ਆਪਣੇ ਸਰੀਰ ਚੋਂ ਪਸੀਨਾ ਕੱਢਣਾ ਚਾਹੀਦਾ ਹੈ ਦੌੜ ਲਗਾਉਣੀ ਚਾਹੀਦੀ ਹੈ ਦੌੜ ਲਗਾਉਣੀ ਬਹੁਤ ਹੀ ਜ਼ਰੂਰੀ ਹੈ ਉਸਦੇ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਤੰਦਰੁਸਤੀ ਵੀ ਰਹਿੰਦੀ ਹੈ ਆਪਣੇ ਅੰਗ ਹੱਥ ਪੈਰ ਅਤੇ ਸਰੀਰ 'ਚ ਫੁਰਤੀ ਹਰ ਟਾਈਮ ਫੁਰਤੀ ਰਹਿੰਦੀ ਹੈ ਜੋ ਕਿ ਦੌੜਨ ਤੋਂ ਬਾਅਦ ਕੁਛ ਦੇਰ ਦੀ ਜੋ ਥਕਾਨ ਹੈ ਉਹ ਉਹ ਹੀ ਉਸ ਦੇ ਨਾਲ ਮਾਨਸਿਕ ਸਿਹਤ ਅਤੇ ਤੰਦਰੁਸਤੀ 'ਤੇ ਸਾਕਾਰਤਮਿਕ ਪ੍ਰਭਾਵ ਪੈਣ ਵਾਲੀ ਗੱਲ ਹੈ